ਬਾਗਬਾਨੀ ਮੇਰਾ ਇੱਕ ਸ਼ੌਂਕ ਆ ਮੇਰਾ ਹਰੀਆਂ ਭਰੀਆਂ ਸਬਜ਼ੀਆਂ ਉਗਾਉਣ ਨੂੰ ਫਲ ਵਗੈਰਾ ਫੁੱਲ ਇਹ ਸਭ ਕੁਛ ਮੈਨੂੰ ਚੰਗਾ ਲੱਗਦਾ ਆ ਮੇਰੀ ਇਹੀਓ ਪ੍ਰੇਰਨਾ ਹੈ ਕਿ ਮੈਂ ਆਪਣੇ ਬਗੀਚੇ ਦੇ ਵਿੱਚ ਸਬਜ਼ੀਆਂ ਉਗਾਵਾਂ ਅਤੇ ਹਰੀਆਂ ਸਬਜ਼ੀਆਂ ਅਸੀਂ ਸਾਰੇ ਖਾਈਏ